ਭਾਰਤੀ ਸਮਾਜ ਵਿੱਚ ਧਰਮ ਦੀ ਬਹੁਤ ਹੀ ਭੂਮਿਕਾ ਹੈ ਲੋਕ ਆਪਣੇ ਆਪਣੇ ਧਰਮ ਵਿੱਚ ਵਿਸ਼ਵਾਸ ਰੱਖਦੇ ਹਨ ਭਾਰਤ ਵਿੱਚ ਬਹੁਤ ਤਰ੍ਹਾਂ ਦੇ ਧਰਮ ਪਾਏ ਜਾਂਦੇ ਹਨ ਜਿਵੇਂ ਸਿੱਖ ਹਿੰਦੂ ਮੁਸਲਿਮ ਈਸਾਈ ਹਰੇਕ ਧਰਮ ਦੇ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਜਿਵੇਂ ਕਿ ਸਾਡੀ ਬਾਣੀ ਵਿੱਚ ਵੀ ਵਿੱਚ ਵੀ ਲਿਖਿਆ ਹੈ ਅਨੇਕਤਾ ਵਿੱਚ ਏਕਤਾ ਕਿ ਸਭ ਨੂੰ ਇਕੱਠੇ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਸਭ ਨਾਲ ਰਲ ਮਿਲ ਕੇ ਰਹੀਏ ਅਤੇ ਸਭ ਦੇ ਧਰਮ ਦਾ ਸਤਿਕਾਰ ਕਰੀਏ ਸਾਡੇ ਸਿੱਖ ਧਰਮ ਵਿੱਚ ਵੀ ਜਿਵੇਂ ਕਿ ਅਸੀਂ ਹਰਮਿੰਦਰ ਸਾਹਿਬ ਜਾਂਦੇ ਹਾਂ ਮੱਥਾ ਟੇਕਣ ਉੱਥੇ ਵੀ ਦਿਖਾਇਆ ਗਿਆ ਹੈ ਕਿ ਉਸਦੇ ਚਾਰ ਦਰਵਾਜ਼ੇ ਰੱਖੇ ਗਏ ਨੇ ਉਹ ਇਸ ਗੱਲ ਦਾ ਪ੍ਰਤੀਕ ਏ ਚਾਰੇ ਦਰਵਾਜ਼ੇ ਸਭ ਧਰਮਾਂ ਲਈ ਬਰਾਬਰ ਨੇ ਸੋ ਹਰ ਇੱਕ ਪ੍ਰਾਣੀ ਦਾ ਇਹੀ ਭੂਮਿਕਾ ਬਣਦੀ ਹੈ ਕਿ ਆਪਾਂ ਰਲ ਮਿਲ ਕੇ ਰਹੀਏ ਅਤੇ ਹਰੇਕ ਧਰਮ ਦਾ ਸਤਿਕਾਰ ਕਰੀਏ